ਆਪਣੀਆਂ ਬਹੁਤ ਸ਼ੈਲੀਆਂ ਹਨ ਜਿਹੜੀਆਂ ਬਹੁਤ ਅੱਜ ਕੱਲ੍ਹ ਅਲੋਪ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਕੱਚੇ ਘਰ ਨੇ ਹੁਣ ਸਾਰੀਆਂ ਇਮਾਰਤਾਂ ਲੋਕ ਇੱਟਾਂ ਦੀਆਂ ਬਣਾ ਰਹੇ ਨੇ ਪੱਥਰਾਂ ਦੀਆਂ ਬਣਾ ਰਹੇ ਹਨ ਜਿਹਨਾਂ ਦੇ ਕਰਕੇ ਪਹਿਲਾਂ ਕੱਚੇ ਘਰ ਹੁੰਦੇ ਸੀਗੇ ਜਿਹਨਾਂ ਦਾ ਬਹੁਤ ਫਾਇਦਾ ਹੁੰਦਾ ਸੀ ਉਹ ਗਰਮੀਆਂ ਦੇ ਵਿੱਚ ਠੰਡੇ ਰਹਿੰਦੇ ਸੀਗੇ ਅਤੇ ਸਿਆਲਾਂ ਦੇ ਵਿੱਚ ਨਿੱਘੇ ਰਹਿੰਦੇ ਹੁੰਦੇ ਸੀ ਅਤੇ ਦੂਜੇ ਨੰਬਰ 'ਤੇ ਅੱਜ ਕੱਲ੍ਹ ਕੱਚੇ ਬਰਤਨ ਵੀ ਖਤਮ ਹੋ ਰਹੇ ਹਨ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹ ਜਿਹੜੇ ਵਿਚਾਰੇ ਬਣਾਉਂਦੇ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਉਹ ਰਸਤੇ ਦੇ ਵਿੱਚ ਇੱਦਾਂ ਹੀ ਰੁਲ ਰਹੇ ਹਨ ਅਤੇ ਤੀਜੇ ਨੰਬਰ 'ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਲੋਕ ਤੂਤ ਦੀਆਂ ਛੀਟੀਆਂ ਲੈਂਦੇ ਸੀਗੇ ਅਤੇ ਉਹ ਬਣਾਉਂਦੇ ਸੀਗੇ ਟੋਕਰੇ ਬਣਾਉਂਦੇ ਸੀਗੇ ਤੂਤ ਦੀਆਂ ਅਤੇ ਅੱਜ ਕੱਲ੍ਹ ਉਹ ਸਾਰੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਹੁਣ ਪਿੰਡਾਂ ਦੇ ਵਿੱਚ ਬਹੁਤ ਚੀਜ਼ਾਂ ਘੱਟ ਗਈਆਂ ਸਾਰਿਆਂ ਦੇ ਘਰ ਪੱਕੇ ਹੋ ਗਏ ਕਿਸੇ ਦਾ ਕੋਈ ਕੱਚਾ ਘਰ ਦਿਖਦਾ ਨਹੀਂ ਬਹੁਤ ਜ਼ਿਆਦਾ ਇਹ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ